ਹੈਲੋ ਸ਼ਗੁਨ ਢਾਬੇ ਤੋਂ ਬੋਲ ਰਹੇ ਜੀ ਮੈਂ ਤੁਹਾਡੇ ਢਾਬੇ ਤੋਂ ਸ਼ਾਹੀ ਪਨੀਰ ਰੋਟੀਆਂ ਦਾਲ ਮੱਖਣੀ ਮੰਗਵਾਈ ਸੀ ਜੋ ਕਿ ਬਹੁਤ ਵਧੀਆ ਅ ਟੇਸਟੀ ਬਣੀ ਹੋਈ ਸੀ ਸਾਡੇ ਗੈਸਟ ਆਏ ਸੀ ਸਾਰੇ ਹੀ ਬਹੁਤ ਤਰੀਫ ਕਰ ਰਹੇ ਸਨ ਕਿ ਇਹ ਖਾਣਾ ਕਿਸ ਢਾਬੇ ਤੋਂ ਮੰਗਾਏ ਬਹੁਤ ਹੀ ਟੇਸਟੀ ਹੈ ਇਸ ਕਰਕੇ ਮੈਂ ਤੁਹਾਨੂੰ ਪੰਜ ਤੋਂ ਪੰਜ ਰੇਟਿੰਗ ਨੰਬਰ ਦਿੰਦਾ ਹਾਂ